ਸਤਿ ਸ਼੍ਰੀ ਅਕਾਲ ਜੀ ਮੈਂ ਨਿਕੀਤਾ ਗੱਲ ਕਰ ਰਹੀ ਹਾਂ ਮੈਂ ਤੁਹਾਡੇ ਪੇਜ ਤੋਂ ਇੱਕ ਫ਼ੋਨ ਔਰਡਰ ਕੀਤਾ ਸੀ ਜਿਸਦੀ ਡਿਲੀਵਰੀ ਪੰਦਰਾਂ ਦਿਨਾਂ ਦੀ ਸੀ ਪਰ ਇਹ ਮੈਨੂੰ ਇੱਕ ਮਹੀਨੇ ਬਾਅਦ ਰਿਸੀਵ ਹੋਇਆ ਹੈ ਅਤੇ ਇਸਦੀ ਪੈਕਿੰਗ ਬਹੁਤ ਜ਼ਿਆਦਾ ਹੀ ਘਟੀਆ ਕੁਆਲਿਟੀ ਦੀ ਸੀ ਅਤੇ ਮੈਂ ਬਲੈਕ ਕਲਰ 'ਚ ਔਰਡਰ ਕੀਤਾ ਸੀ ਅਤੇ ਇਹ ਮੈਨੂੰ ਰੈੱਡ ਕਲਰ ਦੇ ਵਿੱਚ ਰਿਸੀਵ ਹੋਇਆ ਏ ਇਸ ਦਾ ਗਲਾਸ ਕਾਰਡ ਪਹਿਲਾਂ ਹੀ ਟੁੱਟਿਆ ਹੋਇਆ ਸੀ ਅਤੇ ਇਹ ਜਲਦੀ ਜਲਦੀ ਓਨ ਵੀ ਨਹੀਂ ਹੁੰਦਾ ਅਤੇ ਓਨ ਹੋਣ 'ਤੇ ਇਸਦੀ ਪੂਰੀ ਸਕਰੀਨ ਬਲੈਂਕ ਹੋ ਜਾਂਦੀ ਹੈ ਅਤੇ ਇਸਦੇ ਵਿੱਚ ਨੈੱਟਵਰਕ ਕਨੈਕਟੀਵਿਟੀ ਵੀ ਨਹੀਂ ਹੈ ਅਤੇ ਮੈਂ ਆਪਣੇ ਫਰੈਂਡਸ ਨੂੰ ਬਿਲਕੁਲ ਵੀ ਸੁਜੈਸ਼ਨ ਨਹੀਂ ਕਰਾਂਗੀ ਕਿ ਉਹ ਤੁਹਾਡੇ ਪੇਜ ਤੋਂ ਕਦੇ ਵੀ ਸ਼ੋਪਿੰਗ ਕਰਨ ਅਤੇ ਮੇਰੇ ਜੋ ਵੀ ਪੈਸੇ ਹੈ ਤੁਸੀਂ ਮੈਨੂ ਰਿਫੰਡ ਕਰ ਦਿਓ ਮੈਂ ਤੁਹਾਡੀ ਸਰਵਿਸ ਤੋਂ ਬਿਲਕੁਲ ਵੀ ਖੁਸ਼ ਨਹੀਂ ਹਾਂ